ਸਤਿ ਸ਼੍ਰੀ ਕਾਲ ਜੀ ਭਾਰਤ ਵਿੱਚ ਅਲੱਗ ਅਲੱਗ ਧਰਮ ਦੇ ਲੋਕ ਰਹਿੰਦੇ ਹਨ ਅਤੇ ਉਹ ਅਲੱਗ ਅਲੱਗ ਸਥਾਨਾਂ 'ਤੇ ਵੀ ਜਾਂਦੇ ਹਨ ਜਿਵੇਂ ਕਿ ਜੋ ਸਿੱਖ ਹਨ ਉਹ ਗੁਰਦੁਆਰੇ ਜਾਂਦੇ ਹਨ ਜੋ ਹਿੰਦੂ ਹਨ ਬਾਹਮਣ ਹਨ ਉਹ ਮੰਦਰਾਂ ਵਿੱਚ ਜਾਂਦੇ ਹਨ ਜੋ ਮੁਸਲਮਾਨ ਹਨ ਉਹ ਮਸਜਿਦਾਂ ਵਿੱਚ ਜਾਂਦੇ ਹਨ ਅਤੇ ਜੋ ਲੋਕ ਕ੍ਰਿਸਚਨ ਹਨ ਉਹ ਚਰਚਾਂ ਵਿੱਚ ਜਾਂਦੇ ਹਨ ਹਰ ਇੱਕ ਦਾ ਰੱਬ ਅਲੱਗ ਹੈ ਸੋ ਉਸਨੂੰ ਅਲੱਗ ਰੂਪ ਵਿੱਚ ਮੰਨਦੇ ਹਨ ਗੁਰ ਸਭ ਜੇ ਸਭ ਵੇਖਿਆ ਜਾਵੇ ਤਾਂ ਇੱਥੇ ਦੇਸ਼ ਵਿੱਚ ਅਲੱਗ ਅਲੱਗ ਧਰਮ ਹਨ ਅਲੱਗ ਅਲੱਗ ਸਥਾਨ ਹਨ ਉਹਨਾਂ ਦੇ ਅਤੇ ਅਲੱਗ ਅਲੱਗ ਲੋਕ ਹਨ ਪਰ ਉਹ ਸਭ ਇੱਕੋ ਹੀ ਰੱਬ ਨੂੰ ਮੰਨਦੇ ਹਨ ਅਤੇ ਉਸ ਦੇ ਅਲੱਗ ਅਲੱਗ ਰੂਪਾਂ ਨੂੰ ਹੀ ਪੂਜਦੇ ਹਨ ਜੋ ਜੋ ਸਿੱਖ ਧਰਮ ਹੈ ਉਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸ ਗੁਰੂ ਸਾਹਿਬਾਨਾਂ ਨੂੰ ਮੰਨਿਆ ਜਾਂਦਾ ਹੈ ਉਹ ਗੁਰਦੁਆਰੇ ਸਾਹਿਬ ਜਾਂਦੇ ਹਨ ਉਹ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋ ਕੇ ਆਪਣੀ ਇੱਛਾਵਾਂ ਦੀ ਇੱਛਾਵਾਂ ਦੱਸਦੇ ਹਨ ਅਤੇ ਉਹਨਾਂ ਦੇ ਜੋ ਸਿਧਾਂਤ ਹਨ ਉਹਨਾਂ ਦੇ ਉੱਤੇ ਚੱਲ ਕੇ ਆਪਣੇ ਜੀਵਨ ਵਿੱਚ ਆਪਣੀ ਮਰਿਆਦਾ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਹੀ ਆਪਣਾ ਜੀਵਨ ਸਮਝਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਮੇ ਤਿੰਨ ਜੋ ਪ੍ਰਮੁੱਖ ਉਪਦੇਸ਼ ਹਨ ਉਹ ਜਿਵੇਂ ਹਨ ਕਿ ਨਾਮ ਜਪਣਾ ਵੰਡ ਛਕਣਾ ਕਿਰਤ ਕਰਨੀ ਇਹ ਤਿੰਨ ਉਪਦੇਸ਼ਾਂ ਨਾਲ ਹੀ ਆਪ ਜੀ ਇਨਸਾਨ ਇੱਕ ਆਪਣਾ ਵਧੀਆ ਜੀਵਨ ਬਤੀਤ ਕਰ ਸਕਦਾ ਹੈ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਹੀ ਦੱਸਿਆ ਗਿਆ ਹੈ ਹਰ ਧਰਮ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਤਿਉਹਾਰ ਵੀ ਮਨਾਏ ਜਾਂਦੇ ਹਨ ਜਿਵੇਂ ਕਿ ਅਨੰਦਪੁਰ ਸਾਹਿਬ ਦੀ ਹੋਲੀ ਤਾਂ ਬਹੁਤ ਮਸ਼ਹੂਰ ਹੈ ਜਦੋਂ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਉਸ ਨੂੰ ਵੀ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਹਿੰਦੂਆਂ ਵਿੱਚ ਜੋ ਸ਼ਿਵਰਾਤਰੀ ਹੁੰਦੀ ਹੈ ਉਸ ਨੂੰ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਧੂਮ ਧਾਮ ਨਾਲ ਬਣਾਇਆ ਜਾਂਦਾ ਹੈ ਜਦੋਂ ਨੌਂ ਦਿਨਾਂ ਵਾਸਤੇ ਨਵਰਾਤਰੇ ਹੁੰਦੇ ਹਨ ਇਸ ਵਿੱਚ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਨੂੰ ਵੀ ਬਹੁਤ ਧੂਮ ਧਾਮ ਵਿ ਨਾਲ ਮਨਾਇਆ ਜਾਂਦਾ ਹੈ ਗਣੇਸ਼ ਚਤੁਰਥੀ ਨੂੰ ਵੀ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇਸ ਤਰ੍ਹਾਂ ਹੀ ਪੀਰਾਂ ਫਕੀਰਾਂ ਦੇ ਬਹੁਤ ਸਾਰੇ ਮੇਲੇ ਵੀ ਲੱਗਦੇ ਹਨ ਭਾਰਤ ਵਿੱਚ ਅਤੇ ਉਹਨਾਂ ਵਿੱਚ ਉੱਥੇ ਵੀ ਲੋਕ ਜਾ ਕੇ ਆਪਣੀ ਮਰਿਆ ਆਪਣੀ ਜਾ ਕੇ ਆਪਣਾ ਆਨੰਦ ਲੈਂਦੇ ਹਨ ਅਤੇ ਆਪਣੀ ਇੱਛਾਵਾਂ ਪੂਰੀਆਂ ਕਰਦੇ ਹਨ ਇਸ ਤਰ੍ਹਾਂ ਹੀ ਪੰਜਾਬ ਵਿੱਚ ਅਲੱਗ ਅਲੱਗ ਜਗ੍ਹਾ ਹਨ ਅਲੱਗ ਅਲੱਗ ਤਿਉਹਾਰ ਹਨ ਅਲੱਗ ਅਲੱਗ ਲੋਕ ਹਨ ਅਤੇ ਉਹ ਹਰ ਇੱਕ ਧਰਮ ਦਾ ਇਕ ਅਲੱਗ ਕਾਇਦੇ ਕਾਨੂੰਨ ਹੁੰਦੇ ਹਨ ਅਤੇ ਉਹਨਾਂ ਦੇ ਵਿੱਚ ਰਹਿ ਕੇ ਲੋਕ ਆਪਣੇ ਆਪਣੇ ਜੋ ਧਰਮ ਹਨ ਉਹਨਾਂ ਵਿ ਨੂੰ ਮੰਨਦੇ ਹਨ ਧੰਨਵਾਦ